ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਹਰਬਚਨ ਸਿੰਘ ਜੀ ਬੋਲਦੇ ਹੋ ਨਾ ਅੱਛਾ ਅੱਛਾ ਉਹ ਪਤਾ ਨਾ ਅੱਜ ਆਪਾਂ ਗੁਰਦੁਆਰਾ ਸਾਹਿਬ ਮਿਲੇ ਸੀ ਸਵੇਰੇ ਹਾਂ ਹਾਂ ਮੈਂ ਸ਼ਰਮਾ ਜੀ ਬੋਲਦਾ ਜੀ ਅਸੀਂ ਇੱਥੇ ਨਵੇਂ ਰਹਿਣ ਲੱਗੇ ਹਾਂ ਤੁਹਾਡੇ ਮੁਹੱਲੇ 'ਚ

ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਅਤੇ ਥੋੜ੍ਹੀ ਜਿਹੀ ਨਾ ਪ੍ਰੋਬਲਮ ਹੈਗੀ ਮੈਨੂੰ ਥੋੜ੍ਹੀ ਜਿਹੀ ਅਸੀਂ ਨਾ ਹੁਣੀ ਸ਼ਿਫਟ ਕੀਤਾ ਅਤੇ ਬੱਚਿਆਂ ਨੂੰ ਮੈਂ ਦੁੱਧ ਵਗੈਰਾ ਜਿਹਾ ਨਹੀਂ ਆ ਰਿਹਾ ਸੂਟ ਇੱਥੇ ਹਾਂਜੀ ਹਾਂਜੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਮੈਂ ਸੋਚਿਆ ਤੁਹਾਡੇ ਨਾਲ ਗੱਲ ਕੀਤੀ ਜਾਵੇ ਹੈਗੇ ਜੀ ਫਿਰ ਦੱਸ ਪਾਉ ਜੀ ਮੈਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਰੇਟ ਕੀ ਹੈ ਬਾਈ ਜੀ ਉਹਨਾਂ ਦਾ ਅੱਛਾ ਮੱਝ ਦਾ ਹੈਗਾ ਸੱਤਰ ਰੁਪਏ ਉਹਨਾਂ ਕੋਲ ਅੱਛਾ ਅੱਛਾ ਠੀਕ ਹੈ ਜੀ ਅੱਛਾ ਜੀ ਅੱਛਾ ਸਾਰੇ ਪ੍ਰੋਡਕਟ ਹੈਗੇ ਮਿਲਦੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਅਤੇ ਤੁਸੀਂ ਕਿੰਨੇ ਚਿਰ ਤੋਂ ਯੂਜ ਕਰਦੇ ਹੋ ਜੀ ਸ ਹਾਂਜੀ ਅੱਛਾ ਅੱਛਾ ਕਦੇ ਕੋਈ ਸ਼ਿਕਾਇਤ ਨਹੀਂ ਆਈ ਮਤਲਬ ਕਿ ਅੱਛਾ ਜੀ ਹਾਂਜੀ ਅੱਛਾ ਅੱਛਾ ਅੱਛਾ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਅੱਛਾ ਠੀਕ

ਅੱਛਾ ਜੀ ਅੱਛਾ ਜੀ

ਅੱਛਾ ਅੱਛਾ ਘਿਓ ਘਿਓ ਵਗੈਰਾ ਵੀ ਮਿਲ ਜਾਂਦਾ ਠੀਕ ਹੈ

ਅੱਛਾ ਅੱਛਾ ਠੀਕ ਹੈ ਫਿਰ ਨਾ ਤੁਸੀਂ ਨਾ ਥੋੜ੍ਹੀ ਜਿਹੀ ਖੇਚਲ ਹੋਰ ਕਰ ਲਿਓ ਕੱਲ੍ਹ ਨੂੰ ਨਾ ਜੇ ਦੁੱਧ ਲੈਣ ਗਏ ਮੈਨੂੰ ਮਾੜਾ ਜਿਹਾ ਫੋਨ ਮਾਰ ਲਿਓ ਮੈਨੂੰ ਨਾਲ ਲੈ ਜਿਓ ਅਤੇ ਜਾ ਹਾਂ ਹਾਂ ਜਾਣ ਪਛਾਣ ਕਰਾਇਉ ਉਹ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਠੀਕ ਹੈ ਓਕੇ ਚਲੋ ਠੀਕ ਹੈ ਜੀ ਧੰਨਵਾਦ ਬਾਈ ਜੀ ਤੁਹਾਡਾ ਓਕੇ ਠੀਕ ਹੈ